ਕਰੋਨਾ ਕਾਲ ਦੇ ਵਿੱਚ ਬੜੇ ਹੀ ਜ਼ਿਆਦਾ ਅਸੀਂ ਖਾਣਾ ਪਕਾਉਣ ਦੇ ਵਿੱਚ ਪ੍ਰਯੋਗ ਕੀਤਾ ਹੈ ਮੈਂ ਸਭ ਤੋਂ ਵੱਧ ਫਿਊਜ਼ਨ ਪਕਵਾਨਾਂ ਦੇ ਉੱਤੇ ਪ੍ਰਯੋਗ ਕੀਤਾ ਜਿਵੇਂ ਕਿ ਲੋਕ ਖਾਂਦੇ ਮੈਗੀ ਆਪਣੇ ਹਿਸਾਬ ਨਾਲ ਬਣਾ ਕੇ ਦੋ ਮਿੰਟਾਂ ਵਿੱਚ ਮੈਂ ਮੈਗੀ ਬਣਾਈ ਪੰਦਰਾਂ ਮਿੰਟਾਂ ਵਿੱਚ ਭਲਾ ਕਿਵੇਂ ਮੈਂ ਬਣਾਉਨਾ ਸੀ ਮਟਰ ਪਨੀਰ ਉਹਦੀ ਜਗ੍ਹਾ ਮੈਂ ਪਹਿਲਾਂ ਬਣਾ ਦਿੱਤਾ ਸਾਰਾ ਮਸਾਲਾ ਅਤੇ ਮੇਰੇ ਵੇਖੇ ਮੇਰੇ ਮਾਤਾ ਪਿਤਾ ਅਤੇ ਵੇਖਦੇ ਵੇਖਦੇ ਮੈਂ ਉਸ ਮਸਾਲੇ ਦੇ ਵਿੱਚ ਮਟਰ ਪਨੀਰ ਨਾ ਪਾਇਆ ਮੈਂ ਕੀ ਪਾਇਆ ਮੈਗੀ ਦੇ ਬਣਾ ਕੇ ਪੂਰੇ ਨਗੇਟਸ ਉਫ ਚੁੱਕੇ ਅਤੇ ਉਹਦੇ ਵਿੱਚ ਸੁੱਟੇ ਇਹ ਹੋ ਗਿਆ ਮੇਰਾ ਇੱਕ ਫਿਊਜ਼ਨ ਪਕਵਾਨ ਜਿਹੜਾ ਕਿ ਵੱਖਰੇ ਵੱਖਰੇ ਸੱਭਿਆਚਾਰਕ ਪਰੰਪਰਾਵਾਂ ਨੂੰ ਮਿਲਾ ਗਿਆ ਇਹ ਸਭ ਨੂੰ ਪਤਾ ਮੈਗੀ ਹੋ ਗਈ ਨੂਡਲਸ ਹੋ ਗਏ ਇਹ ਭਾਰਤੀ ਸੱਭਿਆਚਾਰ ਦਾ ਹਿੱਸਾ ਨਹੀਂ ਨੇ ਪਰ ਮਟਰ ਪਨੀਰ ਹੋ ਗਿਆ ਕੋਈ ਸਬਜ਼ੀਆਂ ਜਿਹਨਾਂ ਦੀ ਗਰੇਵੀ ਜਿਹਨਾਂ ਦੀ ਤਰੀ ਬਣਾਉਂਦੇ ਹਾਂ ਅਸੀਂ ਆਮ ਮਸਾਲਿਆਂ ਨੂੰ ਪਿਆਜ਼ ਟਮਾਟਰ ਸਾਰਾ ਤੜਕਾ ਲਗਾ ਕੇ ਉਹ ਤੜਕੇ ਲਗਾ ਲਗਾ ਕੇ ਉਹਦੇ ਵਿੱਚ ਹੈ ਚੀਜ਼ ਬਣਾਈ ਇਹ ਬਣ ਗਿਆ ਸਾਡਾ ਇੱਕ ਫਿਊਜ਼ਨ ਪਕਵਾਨ